ਨਮਸ਼ਕਾਰ ਜੀ ਮੈਂ ਗੁਰਦਾਸਪੁਰ ਤੋਂ ਪਰਮਜੀਤ ਕੌਰ ਗੱਲ ਕਰ ਰਹੀ ਹਾਂ ਜੀ ਹਾਂ ਮੈਂ ਯੋਗਾ ਕਲਾਸ ਲਈ ਲਈ ਸੀ ਜੀ ਹਾਂ ਮੈਂ ਯੋਗਾ ਕਲਾਸ ਲਈ ਸੀ ਸਾਡੇ ਸ਼ਹਿਰ ਵਿੱਚ ਯੋਗਾ ਕਲਾਸ ਫ੍ਰੀ ਕਰਵਾਈ ਜਾਂਦੀ ਸੀ ਜਿਸ ਵਿੱਚ ਮੈਂ ਇੱਕ ਵਾਰ ਵਜਰ ਆਸਨ ਪਦਮ ਆਸਨ ਅਤੇ ਸੁਖਆਸਨ ਕੀਤੇ ਸਨ ਪਰ ਮੈਨੂੰ ਇਹ ਆਸਨ ਬੜੇ ਔਖੇ ਲੱਗੇ ਸੀ ਮੈਂ ਹੁਣ ਹਲਕੇ ਫੁਲਕੇ ਯੋਗ ਆਸਨ ਹੀ ਕਰਦੀ ਹਾਂ ਜੋ ਕਿ ਮੇਰੇ ਸਰੀਰ ਨੂੰ ਆਸਾਨ ਲੱਗਦੇ ਹਨ ਹੁਣ ਜਿਸ ਵਿੱਚ ਮੈਂ ਓਮ ਵਿਲੋਮ ਆਸਨ ਪਦਮ ਆਸਨ ਆਸਾਨ ਆਦਿ ਕਈ ਤਰ੍ਹਾਂ ਦੇ ਆਸਨ ਜੋ ਕਿ ਜੋ ਕਿ ਆਸਨ ਨਾਲ ਹੀ ਸਾਡੇ ਸਾਰੇ ਸਰੀਰ ਵਿੱਚ ਚੁਸਤੀ ਅਤੇ ਫੁਰਤੀ ਲਿਆ ਸਕਦੇ ਹਨ ਸਾਡੇ ਸ਼ਹਿਰ ਵਿੱਚ ਯੋਗਾ ਕਲਾਸਾਂ ਵੀ ਲੱਗਦੀਆਂ ਹਨ ਜਿਸ ਵਿੱਚ ਸਵੇਰੇ ਛੇ ਤੋਂ ਅੱਠ ਵਜੇ ਤੱਕ ਯੋਗ ਕਲਾਸ ਹੁੰਦੀ ਹੈ ਜਿਸ ਵਿੱਚ ਔਰਤਾਂ ਅਤੇ ਆਦਮੀ ਭਾਗ ਲੈਂਦੇ ਹਨ ਯੋਗਾ ਕਲਾਸ ਵਿੱਚ ਸਾਨੂੰ ਕਈ ਤਰ੍ਹਾਂ ਦੇ ਯੋਗਾ ਵੀ ਸਿਖਾਉਂਦੇ ਹਨ ਅਤੇ ਜਿਸ ਵਿੱਚ ਸਾਨੂੰ ਸਿਹਤ ਚੰਗੀ ਲੱਗਦੀ ਹੈ ਅਤੇ ਤੰਦਰੁਸਤੀ ਹੀ ਮਹਿਸੂਸ ਹੁੰਦੀ ਹੈ